ਉੱਦਾਂ ਮੈਨੂੰ ਸ਼ੁਰੂ ਤੋਂ ਖਾਣਾ ਬਣਾਉਣ ਦਾ ਬਹੁਤ ਸ਼ੌਕ ਆ ਅਤੇ ਖਾਣਾ ਪਕਾਉਣ ਦੇ ਪੇਸ਼ੇ ਨੂੰ ਲੈ ਕੇ ਮੈਂ ਮੈਂ ਕੀ ਸੋਚਿਆ ਨਹੀਂ ਹੈਗਾ ਹਾਲੇ ਕੁਛ ਵੀ ਹੈ ਨਾ ਜਿਵੇਂ ਲੈ ਕੇ ਜਾਣਾ ਕਿਉਂਕਿ ਜੇ ਮੈਂ ਲੈ ਕੇ ਜਾਂਦੀ ਤਾਂ ਘਰਦਿਆਂ ਦੇ ਮੈਨੂੰ ਨੈਗੇਟਿਵ ਵਿਊਜ਼ ਹੀ ਮਿਲਣੇ ਸੀਗੇ ਕਿਉਂਕਿ ਉਹਨਾਂ ਨੇ ਮੇਰੀ ਹੈਲਪ ਤਾਂ ਕਰਨੀ ਸੀਗੀ ਕਰਨੀ ਨਹੀਂ ਸੀ ਉਹਨਾਂ ਨੇ ਕਹਿਣਾ ਸੀਗਾ ਕਿ ਹੁਣ ਤੂੰ ਐਨਾ ਪੜ੍ਹੀ ਲਿਖੀ ਹੈ ਤਾਂ ਹੁਣ ਭਾ ਢਾਬਿਆਂ 'ਤੇ ਕੰਮ ਕਰੇਂਗੀ ਹੈ ਨਾ ਉਹਨਾਂ ਦੇ ਲੋਕਾਂ ਦੇ ਵਿੱਚ ਗੈਰਾਂ ਦੇ ਵਿੱਚ ਜਾ ਕੇ ਤੂੰ ਕੰਮ ਕਰਿਆ ਕਰੇਂਗੀ ਨਾਲੇ ਲੋਕ ਸਾਨੂੰ ਕੀ ਕਹਿਣਗੇ ਅਤੇ ਹੁਣ ਇੱਦਾਂ ਦੀਆਂ ਗੱਲਾਂ ਨੂੰ ਲੈ ਕੇ ਉਹਨਾਂ ਨੇ ਮੈਨੂੰ ਬਹੁਤ ਕਹਿਣਾ ਸੀਗਾ ਅਤੇ ਮਤਲਬ ਉਹਨਾਂ ਨੇ ਮੈਨੂੰ ਕਦੇ ਵੀ ਇੱਦਾਂ ਕਰਨ ਨਹੀਂ ਸੀ ਦੇਣਾ ਉਹ ਕੰਮ ਤਾਂ ਕਦੇ ਵੀ ਨਹੀਂ ਸੀ ਕਰਨ ਦੇਣਾ ਪਰ ਮੈਨੂੰ ਸ਼ੌਕ ਤਾਂ ਹੁੰਦਾ ਸੀਗਾ ਕਿ ਮੈਂ ਹੈ ਨਾ ਖਾਣਾ ਬਣਾਵਾ ਚਲੋ ਆਪਾਂ ਸਕੂਲ ਦੇ ਕੰਪੀਟੀਸ਼ਨ 'ਚ ਜਦੋਂ ਉਹ ਕਰਦੇ ਹੁੰਦੇ ਸੀ ਉੱਥੋਂ ਹੀ ਮੈਂ ਬਹੁਤ ਕੀਤਾ ਸੀਗਾ ਅਤੇ ਫਸਟ ਪੁਜੀਸ਼ਨ ਕਦੇ ਸੈਕਿੰਡ ਪੋਜੀਸ਼ਨ ਵੀ ਲੈ ਕੇ ਆਈ ਪਰ ਜੇ ਮੈਨੂੰ ਅੱਗੇ ਤੋਰਨ ਦੀ ਗੱਲ ਸੋਚਦੀ ਤਾਂ ਫਿਰ ਘਰਦਿਆਂ ਵੱਲੋਂ ਤਾਂ ਕਦੇ ਵੀ ਹਾਂ ਮੈਨੂੰ ਮਿਲਦੀ ਨਾ ਅਤੇ ਫਿਰ ਮੈਂ ਇਸ ਬਾਰੇ ਸੋਚਣਾ ਹੀ ਬੰਦ ਕਰ ਦਿੱਤਾ ਸੀਗਾ ਕਿਉਕਿ ਮੈਂ ਕੀ ਹੁਣ ਜਦੋਂ ਘਰ ਦਿਆਂ ਨੇ ਹਾਂ ਹੀ ਨਹੀਂ ਕਰਨੀ ਤਾਂ ਫਾਇਦਾ ਵੀ ਕੀ ਆ ਹੈ ਨਾ ਕਰਨ ਦਾ ਤਾਂ ਸੋਚਣਾ ਬੰਦ ਕਰ ਦਿੱਤਾ ਸੀ ਅਤੇ ਫਿਰ ਘਰਦਿਆਂ ਨੇ ਉਹ ਤੋਂ ਬਾਅਦ ਵ ਵਿਆਹ ਕਰ ਦਿੱਤਾ ਹੁਣ ਮੈਂ ਇਸ ਟਾਈਮ ਮੈਰਿਡ ਹਾਂ ਅਤੇ ਆਪਣੇ ਸਹੁਰੇ ਘਰ ਹੀ ਚੱਲਦੀ ਚੱਲਦੀ ਹੈ ਜਿਹੜੀ ਲਾਈਫ ਹੈ ਨਾ ਤੁਹਾਨੂੰ ਪਤਾ ਹੀ ਹੈ ਜਿਵੇਂ ਚੱਲਦੀ ਹੁੰਦੀ ਹੈ ਹੈ ਨਾ ਇੱਥੇ ਖਾਣਾ ਬਣਾ ਲਈ ਦਾ ਆ ਰਹਿ ਲਈ ਦਾ ਆ ਬਸ ਇੱਦਾਂ ਹੀ ਚੱਲੀ ਜਾਂਦਾ ਅਤੇ ਫਿਰ ਉਹਦੇ ਬਾਰੇ ਕਦੇ ਸੋਚਿਆ ਹੀ ਨਹੀਂ ਹੈਗਾ